ਤੇਰਾਂ ਜਨਵਰੀ ਦੋ ਹਜ਼ਾਰ ਚੌਵੀ ਬਾਰਾਂ ਫਰਵਰੀ ਦੋ ਹਜ਼ਾਰ ਅੱਠ ਸੱਤ ਨਵੰਬਰ ਦੋ ਹਜ਼ਾਰ ਗਿਆਰਾਂ ਬਾਰਾਂ ਦਸੰਬਰ ਦੋ ਹਜ਼ਾਰ ਅੱਠ ਛੇ ਨਵੰਬਰ ਦੋ ਹਜ਼ਾਰ ਛੇ